ਰੂਪਨਗਰ ਜ਼ਿਲ੍ਹੇ ਦੇ ਵਿੱਚ ਕਾਫ਼ੀ ਸਥਾਨਕ ਚੈਰਿਟੀ ਜਾਂ ਭਾਰ ਭਾਈਚਾਰਕ ਸੰਸਥਾਵਾਂ ਹਨ ਜਿਵੇਂ ਕਿ ਭੱਠਾ ਸਾਹਿਬ ਦੇ ਨੇੜੇ ਇੱਕ ਭਾਈ ਮੰਝ ਸਾਹਿਬ ਸੋਸਾਇਟੀਸ ਹੈਗੀ ਹੈ ਜਿਹੜੀ ਕਿ ਲੋਕਾਂ ਦੇ ਵਿੱਚ ਪ੍ਰੇਮ ਪੈਦਾ ਭਾਵਨਾ ਕਰਦੀ ਹੈ ਅਤੇ ਜਿਸ ਦੇ ਜਿਸ ਦਾ ਕਾਰਨ ਉੱਥੇ ਲੋਕ ਵੀ ਸਮਰਥਨ ਕ ਸਮਰਥਨ ਕਰਦੇ ਹਨ ਅਤੇ ਲੋਕਾਂ ਦਾ ਆਪਸ ਵਿੱਚ ਪ੍ਰੇਮ ਅਤੇ ਸਕਾਰਾਤਮਕ ਸੋਚ ਵੀ ਪੈਦਾ ਕਰਦੀ ਹੈ ਅਤੇ ਇਸ ਨ ਇਹਦੇ ਨੇੜੇ ਤੇੜੇ ਰੋਪੜ ਜ਼ਿਲ੍ਹੇ ਦੇ ਨੇੜੇ ਤੇੜੇ ਇੱਕ ਬੁਢਾਪਾ ਘਰ ਹੈ ਜਿੱਥੇ ਜਿ ਜਿਸਦਾ ਨਾਮ ਹੈ ਪ੍ਰਭ ਆਸਰਾ ਜਿੱਥੇ ਕਿ ਬੇਘਰ ਲੋਕਾਂ ਦੀ ਵੱਧਦੀ ਗਿਣਤੀ ਦੇਖੀ ਜਾਂਦੀ ਹੈ ਅਤੇ ਉਹਨਾਂ ਨੂੰ ਉੱਥੇ ਲਿਆ ਕੇ ਉਨ੍ਹਾਂ ਦਾ ਮੁਫ਼ਤ ਇਲਾਜ ਅਤੇ ਉਨ੍ਹਾਂ ਦਾ ਰਹਿਣ ਸਹਿਣ ਅਤੇ ਉਹਨਾਂ ਦੀ ਦੇਖ ਰੇਖ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਭਾਈਚਾਰਕ ਸੰਸਥਾਵਾਂ ਦੇ ਕਾਰਨ ਹੀ ਆਪਸ ਦੇ ਵਿੱਚ ਪ੍ਰੇਮ ਵੱਧਦਾ ਹੈ ਉੱਥੇ ਕੋਈ ਵੀ ਧਰਮ ਅਤੇ ਕੋਈ ਵੀ ਸੰਸਥਾ ਦਾ ਬੰਦਾ ਆ ਕੇ ਆਪਣਾ ਫ਼ਰੀ ਚੈੱਕਅੱਪ ਅਤੇ ਇਲਾਜ ਕਰਵਾ ਸਕਦਾ ਹੈ ਅਤੇ ਇਸ ਕਾਰਨ ਇਹਦੇ ਵਿੱਚ ਇੱਕ ਪ੍ਰੇਮ ਭਾਵਨਾ ਦਾ ਇੱਕ ਸਾਂਝ ਵਰਤੀ ਦਿਖਦੀ ਜਾਂਦੀ ਹੈ ਜਿਸਦਾ ਅਸੀਂ ਲੋਕ ਸਮਰਥਨ ਕਰਦੇ ਹਨ ਅਤੇ ਉਨ੍ਹਾਂ ਨੂੰ ਚੈਰਿਟੀ ਵੀ ਡੋਨੇਟ ਕਰਦੇ ਹਨ